ਪੇਂਡੂ ਖੇਤਰ ਦੇ ਵਿੱਚ ਕਿਸਾਨਾਂ ਨੂੰ ਬਹੁਤ ਸਾਰੀਆਂ ਸਮੱਸਿਆਵਾਂ ਅਤੇ ਚੁਣੌਤੀਆਂ ਦਾ ਸਾਹਮਣਾ ਕਰਨਾ ਅੱਛਾ ਵੀ ਪੈਂਦਾ ਹੈ ਕਿਉਂਕਿ ਇਹਦੇ ਵਿੱਚ ਸਭ ਤੋਂ ਵੱਡੀ ਸਮੱਸਿਆ ਹੈ ਇੱਕ ਆਪਣਾ ਕੁਦਰਤੀ ਮਾਰ ਹੈ ਜੋ ਕੁਦਰਤੀ ਮਾਰ ਹੈ ਬੇਮੌਸਮੀ ਬਰਸਾਤ ਬੇਮੌਸਮੀ ਆਪਣਾ ਗੜ੍ਹੇਮਾਰੀ ਜਿਹਦੇ ਕਾਰਨ ਕਿਸਾਨਾਂ ਦੀ ਬਹੁਤ ਸਾਰੀ ਜਾਣੀ ਕਿ ਛੇ ਮਹੀਨਿਆਂ ਦੀ ਕੀਤੀ ਆਪਣਾ ਖੇਤੀ ਬਰਬਾਦ ਹੋ ਜਾਂਦੀ ਹੈ ਅਤੇ ਉਹਦੇ ਨਾਲ ਜਿਹੜੀ ਕਿਸਾਨਾਂ ਦੀ ਭਰਪਾਈ ਨਹੀਂ ਹੁੰਦੀ ਕਿਉਂਕਿ ਉਸ ਫਸਲ ਤੋਂ ਹੀ ਕਿਸਾਨਾਂ ਨੇ ਆਪਣਾ ਸਾਰਾ ਖਰਚਾ ਆਪਣੇ ਘਰ ਦੀਆਂ ਜ਼ਰੂਰਤਾਂ ਆਪਣਾ ਕਰਨੀਆਂ ਹੁੰਦੀਆਂ ਨੇ ਜੋ ਕਿ ਕਿਸਾਨਾਂ ਦੀ ਜਿਹੜੀ ਭਰਪਾਈ ਹੈ ਉਹ ਜਿਹੜੀਆਂ ਸਰਕਾਰਾਂ ਨੇ ਉਹ ਆਪਣੇ ਸਮੇਂ ਸਿਰ ਵੀ ਨਹੀਂ ਆਪਣਾ ਕਰਦੀਆਂ ਔਰ ਆਪਣਾ ਜਾਂ ਜਿਸਦੇ ਨਾਲ ਕਿਸਾਨਾਂ ਨੂੰ ਬਹੁਤ ਸਾਰੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਕਈ ਵਾਰੀ ਕਿਸਾਨਾਂ ਕੋਲ ਜੋ ਬੀਜ ਹੁੰਦੇ ਨੇ ਉਹ ਬੀਜ ਨਕਲੀ ਹੁੰਦੇ ਨੇ ਉਹ ਜੋ ਬੀਜ ਨਕਲੀ ਹੁੰਦੇ ਨੇ ਉਹ ਉਹਦੇ ਨਾਲ ਕਿਸਾਨਾਂ ਨੂੰ ਬਹੁਤ ਸਾਰੀ ਚੁਣੌਤੀ ਦਾ ਸਾਹਮਣਾ ਕਰਨਾ ਪੈਂਦਾ ਹੈ ਜੋ ਕਿਸਾਨ ਆਪਣੀ ਫਸਲ 'ਤੇ ਸਪਰੇਆਂ ਆਪਣਾ ਕਰਦੇ ਨੇ ਸਪਰੇਆਂ ਕਰਨ ਦੇ ਦੌਰਾਨ ਕੁਛ ਜਿਹੜੀਆਂ ਮੈਡੀਸਨ ਸਪਰੇਆਂ ਨੇ ਉਹ ਪੂਰੀ ਤਰ੍ਹਾਂ ਫਸਲ 'ਤੇ ਅਸਰ ਨਹੀਂ ਆਪਣਾ ਕਰਦੀਆਂ ਕਿਸਾਨਾਂ ਨੂੰ ਦੋ ਦੋ ਤਿੰਨ ਤਿੰਨ ਵਾਰੀ ਸਪਰੇਆਂ ਕਰਨੀਆਂ ਅੱਛਾ ਵੀ ਪੈਂਦੀਆਂ ਨੇ ਜਿਸ ਨਾਲ ਕਿਸਾਨਾਂ ਦਾ ਬਹੁਤ ਆਪਣਾ ਖਰਚਾ ਅੱਛਾ ਵੀ ਹੁੰਦਾ ਹੈ ਅਤੇ ਕਿਸਾਨ ਨੂੰ ਤਾਂ ਹਰ ਇੱਕ ਪੱਖ ਤੋਂ ਮਾਰ ਅੱਛਾ ਵੀ ਪੈਂਦੀ ਹੈ ਅਤੇ ਤਾਂ ਕਿ ਜਿਹੜੀ ਕੁਦਰਤ ਦੀ ਮਾਰ ਹੈ ਉਹ ਬਹੁਤ ਅੱਛਾ ਵੀ ਵੱਡੀ ਮਾਰ ਹੈ ਆਪਣਾ ਜਿਸਦੇ ਨਾਲ ਕਿਸਾਨਾਂ ਦੀ ਜਾਣੀ ਕਿ ਜਿਹੜੀ ਫਸਲ ਪੁੱਤਾਂ ਵਾਂਗੂੰ ਅੱਛਾ ਵੀ ਪਾਲੀ ਹੈ ਉਹ ਜਾਣੀ ਕਿ ਬਰਬਾਦ ਹੁੰਦੀ ਹੈ